ਖਾਣਾ ਬਣਾਉਣ ਦੇ ਸਮੇਂ ਮੈਂ ਇੱਕ ਗੱਲ ਦਾ ਬੜਾ ਖਾਸ ਤੌਰ ਦੇ ਉੱਤੇ ਧਿਆਨ ਰੱਖਦਾ ਹਾਂ ਜਦੋਂ ਮੈਂ ਰਸੋਈ ਦੇ ਵਿੱਚ ਐਂਟਰੀ ਕਰਦਾ ਹਾਂ ਤਾਂ ਮੈਂ ਸਲੰਡਰ ਨੂੰ ਜ਼ਰੂਰ ਚੈੱਕ ਕਰਦਾ ਹਾਂ ਕਿ ਕਿਤੇ ਉਹਦੀ ਗੈਸ ਤਾਂ ਲੀਕੇਜ ਨਹੀਂ ਹੋ ਰਹੀ ਨੰਬਰ ਦੋ ਖਾਣਾ ਬਣਾਉਣ ਤੋਂ ਪਹਿਲਾਂ ਮੈਂ ਐਪ੍ਰਨ ਵੀ ਜ਼ਰੂਰ ਪਾ ਲੈਂਦਾ ਹਾਂ ਤਾਂ ਜੋ ਮੇਰੇ ਕੱਪੜੇ ਗੰਦੇ ਨਾ ਹੋਣ ਅਗਰ ਜੇ ਕੋਈ ਅੱਗ ਦਾ ਕੋਈ ਪਤੰਗਾ ਪੈਂਦਾ ਹੈ ਤਾਂ ਉਹ ਮੇਰੇ ਕੱਪੜਿਆਂ ਨੂੰ ਖ਼ਰਾਬ ਨਾ ਕਰ ਸਕੇ ਅਤੇ ਮੈਂ ਗਲਵਜ਼ ਵੀ ਪਾ ਲੈਂਦਾ ਹਾਂ ਤਾਂ ਜੋ ਕੋਈ ਅੱਗ ਦਾ ਪਤੰਗਾ ਜਾਂ ਕੋਈ ਚਾਕੂ ਨਾਲ ਕੱਟਦੇ ਸਮੇਂ ਸਬਜ਼ੀਆਂ ਮੇਰੇ ਹੱਥ 'ਤੇ ਚਾਕੂ ਦੀ ਧਾਰ ਨਾ ਲੱਗ ਸਕੇ ਗਲਵਜ਼ ਪਾਉਣ ਨਾਲ ਮੈਨੂੰ ਕਾਫੀ ਸੇਫਟੀ ਮਹਿਸੂਸ ਹੁੰਦੀ ਹੈ ਤਾਂ ਮੈਂ ਗਲਵਜ਼ ਪਾ ਕੇ ਹੀ ਕੰਮ ਕਰਦਾ ਹਾਂ ਖਾਣਾ ਬਣਾਉਣ ਦੇ ਸਮੇਂ ਮੈਂ ਇੱਕ ਚੀਜ਼ ਦਾ ਹੋਰ ਵੀ ਖਾਸ ਧਿਆਨ ਰੱਖਦਾ ਹਾਂ

ਫ੍ਰਾਈਪੈਨ ਉਹ ਯੂਜ਼ ਕਰਦਾ ਹਾਂ ਜਿਸਦੇ ਵਿੱਚ ਖਾਣਾ ਸਬਜ਼ੀ ਥੱਲੇ ਨਾ ਲੱਗੇ ਅਤੇ ਮੈਂ ਲੱਕੜ ਦਾ ਫ੍ਰਾਈਪੈਨ ਯੂਜ਼ ਕਰਦਾ ਹਾਂ ਤਾਂ ਜੋ ਸਾਡੀ ਹੱਥ ਨੂੰ ਸੇਕਾ ਨਾ ਲੱਗੇ ਅਤੇ ਫੜਨ ਵਿੱਚ ਆਸਾਨੀ ਰਹੇ ਸੋ ਮੈਂ ਇਹਨਾਂ ਗੱਲਾਂ ਦਾ ਬੜਾ ਧਿਆਨ ਰੱਖਦਾ ਹਾਂ ਅਤੇ ਜਦੋਂ ਮੈਂ ਸਬਜ਼ੀਆਂ ਕੱਟਦਾ ਹਾਂ ਜੋ ਉਸਦਾ ਵੇਸਟ ਹੁੰਦਾ ਹੈ ਉਸ ਨੂੰ ਵੀ ਮੈਂ ਡਸਟਬੀਨ ਵਿੱਚ ਪਾ ਦਿੰਦਾ ਹਾਂ ਤਾਂ ਜੋ ਰਸੋਈ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਦੁਰਗੰਧ ਜਾਂ ਕਚਰਾ ਨਾ ਖਿਲਰੇ ਸੋ ਖਾਣਾ ਬਣਾਉਣ ਦੇ ਸਮੇਂ ਮੈਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦਾ ਹਾਂ ਹਾਂ ਇੱਕ ਗੱਲ ਹੋਰ ਮੈਂ ਖਾਣਾ ਬਣਾਉਂਦੇ ਸਮੇਂ ਸਵਾਦ ਅਨੁਸਾਰ ਨਮਕ ਮਿਰਚ ਹਲਦੀ ਪਾਉਂਦਾ ਹਾਂ ਇਹ ਨਹੀਂ ਕਿ ਮੈਂ ਬਿਨਾਂ ਸਵਾਦ ਅਨੁਸਾਰ ਦੇ ਪਾ ਦਿੰਦਾ ਹਾਂ ਮੈਂ ਪਹਿਲਾਂ ਪੁੱਛਦਾ ਵੀ ਨਮਕ ਤੇਜ਼ ਖਾਣਾ ਹੈ ਜਾਂ ਘੱਟ ਮਿਰਚ ਤੇਜ਼ ਖਾਣੀ ਹੈ ਜਾਂ ਘੱਟ ਹਲਦੀ ਜ਼ਿਆਦਾ ਹੋਵੇ ਜਾਂ ਘੱਟ ਤੇਲ ਦਾ ਤੜਕਾ ਜ਼ਿਆਦਾ ਹੋਵੇ ਜਾਂ ਘੱਟ ਜਾਂ ਬਟਰ ਦਾ ਤੜਕਾ ਜ਼ਿਆਦਾ ਹੋਵੇ ਜਾਂ ਘੱਟ ਸੋ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਬਹੁਤ ਹੀ ਅੱਛਾ ਖਾਣਾ ਬਣਾਉਂਦਾ ਹਾਂ